ਛੱਬੀ ਮਈ ਅਠਾਰ੍ਹਾਂ ਸੌ ਸੰਤਾਲੀ ਛੱਬੀ ਅਗਸਤ ਉੱਨੀ ਸੌ ਸੰਤਾਲੀ ਛੇ ਜੂਨ ਉੱਨੀ ਸੌ ਚੁਰਾਸੀ ਅੱਠ ਸਤੰਬਰ ਉੱਨੀ ਸੌ ਪਚਾਸੀ ਵੀਹ ਅਗਸਤ ਦੋ ਹਜ਼ਾਰ